ਮੈ ਇੱਕ ਦੋ ਦਿਨ ਪਹਿਲਾਂ ਆਪਣਾ ਗੈਸ ਦੀ ਗੈਸ ਸਿਲੰਡਰ ਬੁੱਕ ਕਰਵਾਇਆ ਸੀ ਬਟ ਪਰ ਉਹ ਅਜੇ ਤੱਕ ਪਹੁੰਚ ਘਰ ਨਹੀਂ ਸੀ ਪਹੁੰਚਿਆ ਜਿਸ ਦੌਰਾਨ ਮੈਂ ਗੈਸ ਡਿਲੀਵਰੀ ਵਾਲਿਆਂ ਨੂੰ ਕੋਲ ਕੀਤੀ ਅਤੇ ਉਹਨਾਂ ਨੂੰ ਇਹ ਮੈਸੇਜ ਮੈਸੇਜ ਲਗਾਇਆ ਕਿ ਉਹਨਾਂ ਦੀ ਸਿਲੰਡਰ ਦੀ ਸਪੁਰਦਗੀ ਵਿੱਚ ਦੇਰੀ ਹੋ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਮੈਂ ਉਨ ਮੇਰੇ ਕੋਲ ਕਰਨ ਦੌਰਾਨ ਉਹਨਾਂ ਨੇ ਆਪਣਾ ਡਿਲਵਰੀ ਵਾਲਾ ਜਲਦੀ ਤੋਂ ਜਲਦੀ ਭੇਜਿਆ ਅਤੇ ਸਾਨੂੰ ਗੈਸ ਸਿਲੰਡਰ ਪ੍ਰੋਵਾਈਡ ਕਰਵਾਏ ਗਏ ਇਸ ਦੇ ਨਾਲ ਹੀ ਇਸਦੇ ਨਾਲ ਹੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਤਾਂ ਜੋ ਉਹ ਆਪਣੇ ਕਿਸੇ ਨਾ ਕਿਸੇ ਘਰ ਦੇ ਮਸਲੇ ਜਾਂ ਕੋਈ ਕਿਸੇ ਜ਼ਰੂਰੀ ਕੰਮ ਕਰਕੇ ਉਹ ਸਮੇਂ 'ਤੇ ਸਾਨੂੰ ਸਿਲੰਡਰ ਨਹੀਂ ਦੇ ਸਕੇ ਪਰ ਇਸ ਦੇ ਨਾਲ ਹੀ ਉਹਨਾਂ ਨੇ ਸਾਡੀ ਇੱਕ ਫੋਨ ਕਰਨ 'ਤੇ ਸਾਨੂੰ ਸਿਲੰਡਰ ਦਿੱਤੇ ਸਿਲੰਡਰ ਲਿਆ ਕੇ ਦਿੱਤੇ ਇਸ ਦੇ ਨਾਲ ਹੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਇਹੋ ਜਿਹੀ ਵਧੀਆ ਤੋਂ ਵਧ ਲੋਕਾਂ ਦੀ ਜ਼ਰੂਰਤ ਹੈ ਜੋ ਕਿ ਸਮੇਂ 'ਤੇ ਆ ਕੇ ਆਪਣਾ ਕੰਮ ਕਰ ਸਕਣ ਅਤੇ ਦੂਸਰੇ ਦੀਆਂ ਪਰੇਸ਼ਾਨੀਆਂ ਨੂੰ ਵੀ ਸਮਝ ਸਕਣ